ਪੰਜਾਬ ਵਿੱਚ ਬਹੁਤ ਸਾਰੇ ਮੇਲੇ ਅਤੇ ਤਿਓਹਾਰ ਹਨ ਜਿਸ ਕਰਕੇ ਪੰਜਾਬ ਦੇ ਲੋਕਾਂ ਵਿੱਚ ਮੁੱਖ ਸੱਭਿਆਚਾਰਕ ਅਤੇ ਗਤੀਵਿਧੀਆਂ ਦੇ ਰਾਹ ਬਹੁਤ ਹਨ ਉਹ ਇਹਨਾਂ ਦਾ ਬਹੁਤ ਆਨੰਦ ਮਾਣਦੇ ਹਨ ਜਿਵੇਂ ਇੱਥੋਂ ਦੇ ਲੋਕਾਂ ਨੂੰ ਖੇਡਾਂ ਅਤੇ ਮੇਲਿਆਂ ਦਾ ਬਹੁਤ ਸ਼ੌਂਕ ਹੈ ਪੰਜਾਬ ਦੇ ਲੋਕ ਚਾਹੇ ਕੋਈ ਵੀ ਤਿਓਹਾਰ ਹੋਵੇ ਜਾਂ ਮੇਲਾ ਬਹੁਤ ਪਿਆਰ ਨਾਲ ਮਨਾਉਂਦੇ ਹਨ ਇੱਥੇ ਹਰ ਤਿਉਹਾਰ 'ਤੇ ਲੋਕ ਇੱਕਠੇ ਹੋ ਕੇ ਆਪਣੀ ਖੁਸ਼ੀ ਮਨਾਉਂਦੇ ਹਨ ਇੱਕ ਦੂਜੇ ਦੇ ਘਰ ਜਾ ਕੇ ਤੋਹਫੇ ਦਿੰਦੇ ਹਨ ਹਰ ਖੇਤਰ ਵਿੱਚ ਵੱਖ ਵੱਖ ਤਰ੍ਹਾਂ ਦੇ ਤਿਉਹਾਰ ਹੁੰਦੇ ਹਨ ਉਨ੍ਹਾਂ ਨੂੰ ਮਨਾਉਣ ਦਾ ਤਰੀਕਾ ਵੱਖੋ ਵੱਖਰਾ ਹੁੰਦਾ ਹੈ ਜਿਵੇਂ ਲੋਹੜੀ ਲੋਹੜੀ ਪੰਜਾਬ ਵਿੱਚ ਮਨਾਈ ਜਾਂਦੀ ਹੈ ਇੱਥੇ ਦਿਨ ਵਿੱਚ ਮੁੰਡੇ ਪਤੰਗਾਂ ਉਡਾਉਂਦੇ ਹਨ ਕੁੜੀਆਂ ਲੋਹੜੀ ਮੰਗਣ ਘਰਾਂ ਘਰਾਂ ਵਿੱਚ ਜਾਂਦੀਆਂ ਹਨ ਅਤੇ ਰਾਤ ਨੂੰ ਪੂਰੇ ਪਰਿਵਾਰ ਨਾਲ ਬੈਠ ਕੇ ਭੁੱਗਾ ਬਾਲਿਆ ਜਾਂਦਾ ਹੈ ਗੀਤ ਗਾਏ ਜਾਂਦੇ ਹਨ ਹਾਸਾ ਮਜ਼ਾਕ ਕੀਤਾ ਜਾਂਦਾ ਹੈ ਜਿਸ ਘਰ ਵਿੱਚ ਮੁੰਡਾ ਜੰਮਿਆ ਹੋਵੇ ਉਸ ਦੇ ਉਸ ਮੁੰਡੇ ਦੀ ਜੰਮਣ ਦੀ ਖੁਸ਼ੀ ਵਿੱਚ ਲੋਹੜੀ ਵੰਡੀ ਜਾਂਦੀ ਹੈ ਪ੍ਰੋਗਰਾਮ ਕੀਤਾ ਜਾਂਦਾ ਹੈ ਰਾਤ ਨੂੰ ਭੁੱਗਾ ਵਾਲਿਆ ਜਾਂਦਾ ਹੈ ਗੀਤ ਗਾਏ ਜਾਂਦੇ ਹਨ ਨੱਚਿਆ ਟੱਪਿਆ ਜਾਂਦਾ ਹੈ ਪੰਜਾਬ ਵਿੱਚ ਸੌਣ ਦਾ ਮਹੀਨੇ ਤੀਆਂ ਲੱਗਦੀਆਂ ਹਨ ਕੁੜੀਆਂ ਪੇਕੇ ਘਰ ਰਹਿ ਕੇ ਜਾਂਦੀਆਂ ਹਨ ਫਿਰ ਹਰ ਉਮਰ ਦੀਆਂ ਕੁੜੀਆਂ ਬਾਹਰ ਖੁੱਲ੍ਹੀ ਜਗ੍ਹਾ 'ਤੇ ਜਾ ਕੇ ਪੀਘਾਂ ਝੂਟਦੀਆਂ ਹਨ ਗਿੱਧਾ ਪਾਉਂਦੀਆਂ ਹਨ ਗੀਤ ਗਾਉਂਦੀਆਂ ਹਨ ਪੰਜਾਬ ਦਾ ਭੰਗੜਾ ਵੀ ਬਹੁਤ ਮਸ਼ਹੂਰ ਹੈ ਅਸੀਂ ਇਹ ਕਹਿ ਸਕਦੇ ਹਾਂ ਪੰਜਾਬ ਦਾ ਸੱਭਿਆਚਾਰ ਬਹੁਤ ਵਧੀਆ ਹੈ ਜਿਸ ਨਾਲ ਇੱਥੋਂ ਦੇ ਲੋਕਾਂ ਲਈ ਮਨੋਰੰਜਨ ਗਤੀਵਿਧੀਆਂ ਬਹੁਤ ਹਨ ਜਿਸ ਨੂੰ ਉਹ ਪੂਰੇ ਦਿਲ ਨਾਲ ਮਾਣਦੇ ਹਨ